ਸਮੇਂ ਦੇ ਹਿਸਾਬ ਨਾਲ ਪੰਜਾਬੀ ਬੋਲਣ ਦੇ ਵਿੱਚ ਕਾਫੀ ਤਬਦੀਲੀਆਂ ਆਈਆਂ ਹਨ ਦੇਖਣ ਨੂੰ ਮਿਲੀਆਂ ਨੇ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਪੰਜਾਬੀ ਕਾਫੀ ਬੋਲੀ ਜਾਂਦੀ ਸੀ ਹਰ ਇੱਕ ਗੱਲ ਪੰਜਾਬੀ ਠੇਠ ਪੰਜਾਬੀ 'ਚ ਹੀ ਕੀਤੀ ਜਾਂਦੀ ਸੀ ਅਤੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਕਿ ਗੁਰਮੁਖੀ ਲਿਪੀ ਵੀ ਸਿਖਾਈ ਜਾਂਦੀ ਸੀ ਅਤੇ ਗੁਰਦੁਆਰਿਆਂ ਦੇ ਵਿੱਚ ਸੰਥਿਆ ਬਾਣੀ ਪੜ੍ਹਨ ਦੀ ਸੰਥਿਆ ਵੀ ਦਿੱਤੀ ਜਾਂਦੀ ਸੀ ਪਰ ਅੱਜ ਕੱਲ੍ਹ ਸਮਾਂ ਬਦਲ ਗਿਆ ਸਮੇਂ ਦੇ ਅਨੁਸਾਰ ਜਿਹੜਾ ਕਿ ਪੰਜਾਬੀ ਬੋਲੀ ਨੂੰ ਕਾਫੀ ਦੂਰ ਕਰ ਦਿੱਤਾ ਗਿਆ ਹੈ ਅਤੇ ਪੰਜਾਬੀ ਬੋਲਣ ਦੇ ਵਿੱਚ ਵੀ ਸ਼ਰਮ ਮੰਨ ਰਹੇ ਨੇ ਪੰਜਾਬੀ ਲੋਕ ਨੇ ਜਿਹੜੇ ਉਹ ਖੁਦ ਸ਼ਰਮ ਮੰਨਦੇ ਨੇ ਪੰਜਾਬੀ ਲੋਕ ਉਹ ਇੰਗਲਿਸ਼ ਨੂੰ ਜ਼ਿਆਦਾ ਤਰਜੀਹ ਦੇ ਰਹੇ ਨੇ ਪੰਜਾਬੀ ਬੋਲਣੀ ਕਿਤੇ ਪੈ ਜਾਵੇ ਜਾਂ ਕਿਸੇ ਦਫਤਰ ਦੇ ਵਿੱਚ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਅਨਪੜ੍ਹ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬੀ ਸਾਡੀ ਭਾਸ਼ਾ ਹੈ ਸਾਨੂੰ ਪੰਜਾਬੀ ਪਹਿਲ ਦੇ ਅਧਾਰ 'ਤੇ ਹੀ ਬੋਲਣੀ ਚਾਹੀਦੀ ਹੈ ਉੱਥੇ ਵੀ ਉਹਨਾਂ ਨੇ ਹਰ ਇੱਕ ਜਗ੍ਹਾ 'ਤੇ ਜਿਹੜੀ ਕਿ ਇੰਗਲਿਸ਼ ਹੀ ਜ਼ਰੂਰੀ ਕਰ ਛੱਡੀ ਹੈ ਇੰਗਲਿਸ਼ ਬੋਲਣ ਨੂੰ ਉਹ ਇੱਕ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਅਤੇ ਵਧੀਆ ਸਮਝਦੇ ਨੇ ਅਤੇ ਇਸ ਕਰਕੇ ਵੀ ਜਿਹੜਾ ਪੰਜਾਬੀ ਬੋਲਣ ਦੇ ਵਿੱਚ ਸ਼ਰਮ ਮਹਿਸੂਸ ਕਰ ਰਹੇ ਨੇ ਕਾਫੀ ਜ਼ਿਆਦਾ ਇਸ ਕਰਕੇ ਅੱਗੇ ਬਾਹਰ ਜਾਣ ਦੇ ਲਈ ਜਿਵੇਂ ਕਿ ਕੋਈ ਆਈਲੈਟਸ ਦੀ ਲੋੜ ਨਹੀਂ ਸੀ ਵਰਕ ਵੀਜ਼ੇ ਮਿਲਦੇ ਸੀ ਪਰ ਹੁਣ ਬਾਹਰ ਜਾਣ ਲਈ ਵੀ ਜਿਹੜਾ ਕਿ ਹੈਗਾ ਵੀ ਕਾਫੀ ਜ਼ਿਆਦਾ ਵੀ ਆਈਲੈਟਸ ਸੈਂਟਰ ਜਿਹੜੇ ਖੁੱਲ੍ਹ ਚੁੱਕੇ ਨੇ ਅਤੇ ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਲਾਉਂਦੇ ਨੇ ਵੀ ਉਹਨਾਂ ਨੂੰ ਇਹ ਹੋ ਗਿਆ ਵੀ ਅਸੀਂ ਇੰਗਲਿਸ਼ ਜਾਣਦੇ ਹਾਂ ਅਸੀਂ ਬਹੁਤ ਪੜ੍ਹੇ ਲਿਖੇ ਹਾਂ ਵੀ ਚਾਰ ਜਣਿਆਂ 'ਚ ਬਹਿ ਕੇ ਜੇ ਗੱਲ ਕਰਾਂਗੇ ਤਾਂ ਅਸੀਂ ਇੰਗਲਿਸ਼ 'ਚ ਕਰਾਂਗੇ ਪੰਜਾਬੀ 'ਚ ਨਾ ਸਾਨੂੰ ਕੋਈ ਵੀ ਗੱਲ ਕਰਨੀ ਪਵੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਦਿਖਾਉਣ ਦੇ ਲਈ ਵੀ ਉਹ ਪੰਜਾਬੀ ਨੂੰ ਭੁੱਲਦੇ ਤੁਰੇ ਜਾ ਰਹੇ ਨੇ ਅਤੇ ਇੰਗਲਿਸ਼ ਦੀ ਜ਼ਿਆਦਾ ਹੀ ਵਰਤੋਂ ਕਰ ਰਹੇ ਨੇ ਇਸ ਕਰਕੇ ਇਸ ਵਿੱਚ ਕਾਫੀ ਤਬਦੀਲੀਆਂ ਆਈਆਂ ਨੇ ਕਿਉਂਕਿ ਉਹ ਆਪਣੀ ਭਾਸ਼ਾ ਹੀ ਭੁੱਲਦੇ ਜਾ ਰਹੇ ਨੇ ਪੰਜਾਬੀ ਲੋਕ